ਗੁੱਡ ਮੋਰਨਿੰਗ ਗੁਰਪ੍ਰੀਤ ਯੈੱਸ ਯੈੱਸ ਗੁਰਪ੍ਰੀਤ ਤੁਸੀਂ ਇੰਝ ਕਰਨਾ ਮਤਲਬ ਵੀ ਬੱਚਿਆ 'ਤੇ ਸਟਿੱਕਨੈਂਸ ਵਰਤਣੀ ਪੈਣੀ ਹੈ ਤੁਹਾਨੂੰ ਮਤਲਬ ਇਹ ਇਸ ਤਰ੍ਹਾਂ ਵੀ ਕਿ ਆਪਾਂ ਉਹਨਾਂ ਨੂੰ ਕੁਛ ਕਹਿ ਵੀ ਨਹੀਂ ਸਕਦੇ ਇਹ ਵੀ ਅਲੋਅ ਨਹੀਂ ਹੈਗਾ ਸਾਨੂੰ ਆਪਾਂ ਉਹਨਾਂ ਨੂੰ ਮਾਰ ਵੀ ਨਹੀਂ ਸਕਦੇ ਪਰ ਬੱਚਿਆਂ 'ਤੇ ਕੰਟਰੋਲ ਸਿਰਫ ਸਾਡਾ ਹੀ ਆ ਜਦੋਂ ਬੱਚੇ ਸਕੂਲ 'ਚ ਹੁੰਦੇ ਆ ਸਾਰਾ ਜ਼ਿੰਮੇਵਾਰੀ ਸਾਡੀ ਹੁੰਦੀ ਹੈ ਅਤੇ ਇਸ ਲਈ ਉਹਨਾਂ ਨੂੰ ਮਤ ਐ ਕੋਈ ਨਾ ਕੋਈ ਐਕਟੀਵਿਟੀ ਕਰਾਉਂਦੇ ਰਹੋ ਕਲਾਸ 'ਚ ਬਿਜ਼ੀ ਰੱਖੋ ਓਰਲ ਕੁਛ ਸੁਣਦੇ ਰਹੋ ਮਤਲਬ ਵੀ ਉਹਨਾਂ ਨੂੰ ਇੱਧਰ ਉੱਧਰ ਜਾਣ ਦਾ ਬੱਚਿਆਂ ਨੂੰ ਟਾਈਮ ਹੀ ਨਾ ਦਿੱਤਾ ਜਾਵੇ ਨੋ ਨੋੋ ਨੋ ਨੋੋ ਨੋ ਨੋੋ ਗੁਰਪ੍ਰੀਤ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੈ ਮਤਲਬ ਇਹ ਸਟੈਪ ਬਹੁਤ ਵੱਡਾ ਹੋ ਜਾਂਦਾ ਮਤਲਬ ਵੀ ਫਿਰ ਸਾਨੂੰ ਪੇਰੈਂਟਸ ਦਾ ਵੀ ਸੋਚਣਾ ਪੈਂਦਾ ਵਾ ਇੱਕ ਬੱਚੇ ਪਿੱਛੇ ਆਪਾਂ ਇੰਨਾ ਵੱਡਾ ਸਟੈਪ ਨਹੀਂ ਲੈ ਸਕਦੇ ਅਤੇ ਮਤਲਬ ਸਾਨੂੰ ਆਪ ਕੋਪਰੇਟ ਕਰਨਾ ਚਾਹੀਦਾ ਸਭ ਨੂੰ ਕਿ ਮਤਲਬ ਜ਼ਿੰਮੇਵਾਰੀ ਸਾਡੀ ਆ ਆਪਾਂ ਬੱਚਿਆਂ ਦਾ ਮਤਲਬ ਪੂਰਾ ਟੇਕ ਕੇਅਰ ਆਪਾਂ ਹੀ ਕਰਨੀ ਆ ਮਤਲਬ ਆਪਾਂ ਐਜ਼ ਏ ਟੀਚਰ ਬੱਚਿਆਂ ਦੀ ਜਿੰਮੇਵਾਰੀ ਹੋਰ ਬਣਦੀ ਆ ਇਸ ਲਈ ਵੀ ਸਾਡੇ ਬੱਚਿਆਂ ਨੂੰ ਵੀ ਉਹਨਾਂ ਨੂੰ ਬੱਚਿਆਂ ਨੂੰ ਬਲੇਮ ਆਪਾਂ ਕਿਸੇ ਚੀਜ਼ ਤੋਂ ਕਰਦੇ ਹਾਂ ਜਾਂ ਹੋਰ ਕੁਛ ਡਾਂਟਦੇ ਹਾਂ ਉਹ ਵੀ ਠੀਕ ਆ ਉਹ ਵੀ ਜ਼ਰੂਰੀ ਆ ਉਹ ਵੀ ਜ਼ਰੂਰੀ ਆ ਜੇ ਅਦਰਵਾਈਜ਼ ਅਗਰ ਬੱਚੇ ਬਹੁਤ ਤੰਗ ਕਰਦੇ ਆ ਪੇਰੈਂਟਸ ਨੂੰ ਕੋਲ ਕਰੋ ਹਾਂ ਪੇਰੈਂਟਸ ਬੁਲਾਓ ਹਾਂ ਓਕੇ